ਜਿਹੜੀ ਟੈਕਨੋਲਜੀ ਅੱਜ ਕੱਲ੍ਹ ਚੱਲ ਰਹੀ ਆ ਉਹ ਸਾਡੇ ਲਈ ਬਹੁਤ ਵਧੀਆ ਹੈ ਸਾਡੇ ਲਈ ਵੀ ਅਤੇ ਟੈਕਨੋਲਜੀ ਜਿਹੜੀ ਵਾਤਾਵਾਰਨ ਆ ਉਹ ਉਸਦੇ ਲਈ ਵੀ ਬਹੁਤ ਵਧੀਆ ਹੈ ਅੱਜ ਕੱਲ੍ਹ ਜਿਵੇਂ ਕਿ ਇਲੈਕ ਇਲੈਕਟਰੋਨਿਕ ਕਾਰਾਂ ਚੱਲੀਆਂ ਹੋਈਆਂ ਨੇ ਉਹ ਕਾਰਾਂ ਵੀ ਜਿਹੜੀਆਂ ਬਿਜਲੀ ਨਾਲ ਬੈਟਰੀਜ਼ ਨਾਲ ਚਲਦੀਆਂ ਨੇ ਉਸ ਤੋਂ ਬਾਅਦ ਉਹ ਹਰ ਰੋਜ਼ ਯਾਨੀ ਚਲਦੀਆਂ ਰਹਿੰਦੀਆਂ ਨੇ ਪੈਟਰੋਲ ਰੋਜ਼ ਰੋਜ਼ ਯੂਸ ਨਹੀਂ ਹੁੰਦਾ ਉਹਨਾਂ ਉਹਨਾਂ ਵਿੱਚ ਤਾਂ ਪੈਟਰੋਲ ਨਹੀਂ ਲੱਗਦਾ ਜਿਹਦੇ ਕਰਕੇ ਵਾਤਾਵਰਨ ਵਿੱਚ ਪ੍ਰਦੂਸ਼ਣ ਨਹੀਂ ਫੈਲਦਾ ਹੈਗਾ ਧੂੰਆਂ ਵਗੈਰਾ ਨਹੀਂ ਹੁੰਦਾ ਹੈਗਾ ਜਿਸ ਨਾਲ ਲੋਕਾਂ ਨੂੰ ਬਹੁਤ ਬਿਮਾਰੀਆਂ ਲੱਗਦੀਆਂ ਸੀ ਉਹਨਾਂ ਦਾ ਵੀ ਥੋੜ੍ਹਾ ਜਿਹਾ ਫਾਇਦਾ ਹੋਇਆ ਰਹਿੰਦਾ ਅਤੇ ਇਸ ਤੋਂ ਇਲਾਵਾ ਸੋਲਰ ਸਿਸਟਮ ਲੱਗਦੇ ਨੇ ਜਿਹੜੇ ਕਿ ਉਹ ਬਿਜਲੀ ਪੈਦਾ ਕਰਦੇ ਨੇ ਬਿਨਾਂ ਪਾਣੀ ਦੇ ਅਤੇ ਉਹ ਵੀ ਐ ਨਹੀ ਹੈਗਾ ਵੀ ਇੱਕ ਵਾਰ ਆਪਾਂ ਸੋਲਰ ਸਿਸਟਮ ਲਵਾ ਲਿਆ ਅਤੇ ਉਹਦੀ ਦੁਬਾਰਾ ਵਰਤੋਂ ਨਹੀਂ ਹੁੰਦੀ ਉਸਨੂੰ ਆਪਾਂ ਚਾਹੇ ਵੀਹ ਸਾਲ ਯੂਸ ਕਰੀਏ ਚਾਹੇ ਤੀਹ ਸਾਲ ਯੂਸ ਕਰੀਏ ਉਹ ਵੀ ਰੀਨਵਨਲ ਹੋ ਜਾਂਦੇ ਨੇ ਅਤੇ ਬਾਕੀ ਉਸ ਤੋਂ ਬਾਅਦ ਫਿਰ ਆ ਗਈ ਫਰੈਂਡਲੀ ਬੈਟਰੀਆਂ ਜਿਹੜੀ ਕਿ ਪ੍ਰਦੂਸ਼ਣ ਨਹੀਂ ਹੁੰਦਾ ਇਹਨਾਂ ਨਾਲ ਜਿਵੇਂ ਕਿ ਅੱਜ ਕੱਲ੍ਹ ਆਡ ਵੈਂਟਰੀ ਵਾਲੇ ਆਲ ਆਟੋ ਬੈਟਰੀ ਵਾਲੇ ਚਲਦੇ ਨੇ ਗੱਡੀਆਂ ਚੱਲਦੀਆਂ ਨੇ ਬੈਟਰੀ ਵਾਲੇ ਸਾਈਕਲ ਮੋਟਰਸਾਈਕਲ ਉਹਨਾਂ ਨਾਲ ਵੀ ਬਹੁਤ ਚੰਗਾ ਹੋ ਰਿਹਾ ਉਸ ਨਾਲ ਆਲੇ ਦੁਆਲੇ ਸਾਨੂੰ ਪੈਟਰੋਲ ਵੀ ਨਹੀਂ ਲੱਗਦਾ ਅਤੇ ਨਾਲੇ ਪੈਸੇ ਵੀ ਖਰਚ ਨਹੀਂ ਹੁੰਦੇ